ਹੈਲੋ ਹਾਂਜੀ ਕੌਣ ਹਾਂਜੀ ਹਾਂਜੀ ਓਕੇ ਜੀ ਜੀ ਕਿੰਨੇ ਜਾਣੇ ਤੁਸੀਂ ਸਵੇਰੇ ਛੇ ਵਜੇ ਅੱਛਾ ਜੀ ਅਤੇ ਕਿੱਥੋ ਬੋਲਦੇ ਤੁਸੀਂ ਅੱਛਾ ਜੀ ਪਿੰਡ ਰੈਲ ਮਾਜਰਾ ਠੀਕ ਹੈ ਜੀ ਅਤੇ ਛੇ ਸੱਤ ਜਣਿਆ ਦਾ ਜੀ ਫਿਰ ਤੁਹਾਡਾ ਹੋ ਜਾਣਾ ਅਤੇ ਛੇ ਹਜ਼ਾਰ ਲੈਣਾ ਜੀ ਜਿੱਦਾਂ ਤੁਹਾਨੂੰ ਠੀਕ ਲੱਗੇ ਦੇਖਲੋ ਕਿੱਦਾਂ ਕਰੋਗੇ ਹਾਂਜੀ ਹਾਂਜੀ ਅਤੇ ਫਿਰ ਤੁਸੀਂ ਉਦੋਂ ਹੀ ਦੇ ਉਦੋਂ ਹੀ ਕਰਦਿਓ ਪੇਮੈਂਟ ਹਾਂਜੀ ਅਤੇ ਦੱਸਿਓ ਰੈਲ ਮਾਜਰਾ ਕਿੱਥੇ ਕ ਹੈ ਇਹ ਪੈਟਰੋਲ ਪੰਪ ਕਿਹੜਾ ਹੈ ਜੀ ਇਹ ਰੋਪੜ ਦੇ ਰੋਪੜ ਦੇ ਕੋਲ ਹੈ ਨਾ ਹਾਂਜੀ ਅੱਛਾ ਪੁੱਲ ਦੇ ਰਾਈਟ ਹੈਂਡ ਇਹ ਮੈਂ ਜੀ ਕੰਨਫਿਉਜਡ ਆ ਤੁਹਾਡਾ ਜਿਹੜਾ ਲੌਕੇਸ਼ਨ ਦਾ ਮੈਂ ਪਹਿਲਾਂ ਕਦੇ ਆਇਆ ਨੀ ਰੈਲ ਮਾਜਰੇ ਵੱਲ੍ਹ ਅੱਛਾ ਜੀ ਹਾਂਜੀ ਲੌਕੇਸ਼ਨ ਫਿਰ ਜਦੋਂ ਹਾਂਜੀ ਪਰਸੋਂ ਜਾਣਾ ਤੁਸੀਂ ਨਾ ਅਤੇ ਪਰਸੋਂ ਤੁਸੀਂ ਮੈਨੂੰ ਸਵੇਰੇ ਹੀ ਲੌਕੇਸ਼ਨ ਭੇਜ ਦਿਓ ਓਕੇ ਜੀ ਥੈਂਕ ਯੂ